ਪੰਜਾਬ ਵਿੱਚ ਚਰਖੇ ਦੀ ਵਰਤੋਂ ਬਹੁਤ ਪੁਰਾਣੇ ਸਮੇਂ ਤੋਂ ਹੀ ਹੈ ਔਰ ਚਰਖੇ ਦੇ ਨਾਲ਼ ਜਿਹੜਾ ਕੱਤਿਆ ਜਾਂਦਾ ਸੂਤ ਹੈ ਉਹਦੀ ਤਾਂ ਗੱਲ ਹੀ ਵੱਖਰੀ ਹੈ ਇਹ ਫਿਰ ਇਸ ਤੋਂ ਬਾਅਦ ਕੱਪੜਾ ਬਣਦਾ ਹੈ ਤਾਂ ਜਿਹੜੀ ਕਢਾਈਆਂ ਨੇ ਪੰਜਾਬ ਦੇ ਵਿੱਚ ਮੁੱਖ ਤੌਰ 'ਤੇ ਜਿਹੜੀ ਫੁਲਕਾਰੀ ਹੈ ਉਹ ਕਢਾਈ ਫੇਮਸ ਹੈ ਬਾਕੀ ਵੀ ਹੋਰ ਬਹੁਤ ਤਰ੍ਹਾਂ ਦੀਆਂ ਕਢਾਈਆਂ ਨੇ ਜਿਹੜੇ ਫੁਲਕਾਰੀ ਤੋਂ ਸੂਟ ਬਣਦੇ ਨੇ ਚੁੰਨੀਆਂ ਲਈਆਂ ਜਾਂਦੀਆ ਹੈ ਤਾਂ ਨੱਚਦੇ ਫਿਰਦੀਆਂ ਮੁਟਿਆਰਾਂ ਇਹਦੇ ਵਿੱਚ ਦੇਖੀਆਂ ਜਾਂਦੀਆ ਹਨ